ਹੈਲੋ ਹਾਂਜੀ ਹਾਂਜੀ ਅਸੀਂ ਨਾ ਇੱਕ ਕੈਬ ਬੁੱਕ ਕਰਨਾ ਚਾਹੁੰਦੇ ਹਾਂ ਤੁਹਾਡਾ ਡਰਾਇਵਰ ਅੱਛਾ ਹੋਣਾ ਚਾਹੀਦਾ ਹੈ ਅਸੀਂ ਬੱਚਿਆਂ ਨੂੰ ਛੁੱਟੀਆਂ ਹੋਈ ਦੀਆਂ ਅਸੀਂ ਕਿਤੇ ਘੁੰਮਣ ਜਾਣਾ ਚਾਹੁੰਦੇ ਹਾਂ ਲੋਕਲ ਔਰ ਅਸੀਂ ਮੋਰਨਿੰਗ 'ਚ ਜਾ ਕੇ ਇਵਨਿੰਗ ਅਸੀਂ ਵਾਪਿਸ ਆ ਜਾਣਾ ਹੈ ਸਾਨੂੰ ਡਰਾਇਵਰ ਅੱਛਾ ਦਿਓ ਕਿ ਜਿਹੜਾ ਡਰਾਈਵਿੰਗ ਅੱਛੀ ਕਰੇ ਔਰ ਤੁਸੀਂ ਕਿੰਨਾ ਡਿਸਕਾਊਟ ਦਿਓਗੇ ਅਸੀਂ ਮੁਕਤੇਸ਼ਵਰ ਧਾਮ ਜਾਣਾ ਚਾਹੁੰਦੇ ਹਾਂ ਔਰ ਅਸੀਂ ਫਸਟ ਤਰੀਕ ਨੂੰ ਜਾਣਾ ਚਾਹੁੰਦੇ ਹਾਂ ਫਸਟ ਨੂੰ ਸਾਨੂੰ ਮੋਰਨਿੰਗ ਨੌ ਕੁ ਵਜੇ ਪਿੱਕ ਕਰਕੇ ਉਹ ਸ਼ਾਮੀਂ ਸਾਨੂੰ ਘਰ ਛੱਡ ਦਏ ਔਰ ਮੈਂ ਇੰਦਰਾ ਕਲੋਨੀ ਤੋਂ ਬੋਲਿਆ ਕਰਦੀ ਹਾਂ ਕਪੂਰ ਹੋਸਪਿਟਲ ਦੇ ਕੋਲ ਅਸੀਂ ਆ ਕੇ ਆਪਣੀ ਕੈਬ ਲੈ ਲਵਾਂਗੇ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਕਿੰਨਾ ਡਿਸਕਾਊਟ ਸਾਨੂੰ ਦਿਓਗੇ ਔਰ ਤੁਹਾਡੇ ਡਰਾਇਵਰ ਦਾ ਰਿਕੋਰਡ ਵਗੈਰਾ ਅੱਛਾ ਹੋਣਾ ਚਾਹੀਦਾ ਹੈ ਉਹਨੂੰ ਡਰਾਈਵਿੰਗ ਲਾਈਸੈਂਸ ਵਗੈਰਾ ਉਹਦੇ ਕੋਲ ਪੂਰੇ ਕਾਗਜ਼ ਆਪਣੇ ਪ੍ਰੋਪਰ ਹੋਣੇ ਚਾਹੀਦੇ ਹੈ ਕਿ ਰਸਤੇ ਵਿੱਚ ਅਗਰ ਸਾਨੂੰ ਜੇ ਕੋਈ ਪੁੱਛ ਵੀ ਲਵੇ ਅਤੇ ਅਸੀਂ ਮਨਕੀ ਕੋਈ ਝੰਜਟ ਵਿੱਚ ਨਾ ਫਸੀਏ ਡਰਾਇਵਰ ਕੋਲ ਸਾਰੇ ਕਾਗਜ਼ ਹੋਣਗੇ ਤਾਂ ਸਾਨੂੰ ਕੋਈ ਪ੍ਰੋਬਲਮ ਵੀ ਨਹੀਂ ਹੋਏਗੀ ਔਰ ਡਰਾਈਵਿੰਗ ਵੀ ਉਹ ਅੱਛੀ ਕਰਨੀ ਚਾਹੀਦਾ ਹੈ ਕਿਉਂਕਿ ਸਾਡੇ ਨਾਲ ਛੋਟੇ ਛੋਟੇ ਬੱਚੇ ਹੈ ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਰਸਤੇ ਵਿੱਚ ਕਿਸੀ ਚੀਜ਼ ਦੀ ਦਿੱਕਤ ਹੋਏ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੀ ਇਹ ਛੁੱਟੀ ਇੰਜੋਏ ਕਰਨ ਚੱਲੇ ਹਾਂ ਮੁਕਤੇਸ਼ਵਰ ਧਾਮ ਭਗਵਾਨ ਦੇ ਦਰਸ਼ਨ ਕਰਨ ਚੱਲੇ ਹਾਂ ਅਸੀਂ ਅੱਛੀ ਤਰ੍ਹਾਂ ਦਰਸ਼ਨ ਕਰਕੇ ਵਾਪਸ ਆਈਏ ਸਾਨੂੰ ਪ੍ਰੋਬਲਮ ਕੋਈ ਰਸਤੇ ਵਿੱਚ ਨਾ ਹੋਏ ਅਤੇ ਤੁਸੀਂ ਸਾਨੂੰ ਕਨਫਰਮ ਕਰ ਦਿਓ ਕਿ ਤੁਹਾਡਾ ਡਰਾਇਵਰ ਕਿੰਨੇ ਵਜੇ ਪੁੱਜੇਗਾ ਔਰ ਕੀ ਤੁਸੀਂ ਸਾਨੂੰ ਡਿਸਕਾਊਟ ਦਿਓਗੇ ਥੈਂਕ ਯੂ